ਮੈਂ ਵਿਜੇ ਗੁਰਦਾਸਪੁਰ ਜ਼ਿਲ੍ਹੇ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਲਿਖਣ ਦੇ ਕੋਈ ਟੀਚੇ ਜਾਂ ਇੱਛਾਵਾਂ ਕੀ ਹਨ ਮੈਂ ਕੀ ਹਰ ਇੱਕ ਬੰਦੇ ਕੋਲ ਲਿਖਣ ਦੇ ਟੀਚੇ ਨਿਸ਼ਚਿਤ ਹੁੰਦੇ ਹਨ ਜਾਂ ਉਸ ਦੀਆਂ ਇੱਛਾਵਾਂ ਦੇ ਮੁਤਾਬਕ ਹੀ ਲਿਖਿਆ ਜਾਂਦਾ ਹੈ ਜਦੋਂ ਤੱਕ ਕੋਈ ਲਿਖਣ ਦੀ ਸ਼ੈਲੀ ਨੂੰ ਵਧੀਆ ਤਰੀਕੇ ਨਾਲ ਨਹੀਂ ਸੋਚ ਸਕਦਾ ਤਾਂ ਉਹ ਉਸ ਉਦੋਂ ਤੱਕ ਉਹ ਵਧੀਆ ਤਰੀਕੇ ਨਾਲ ਲਿਖ ਨਹੀਂ ਸਕਦਾ ਕੋਈ ਇਨਸਾਨ ਯਥਾਰਥ ਭਾਵ ਸੱਚਾਈ ਦੇ ਤੌਰ 'ਤੇ ਲਿਖਦਾ ਹੈ ਕੋਈ ਕਾਲਪਨਿਕ ਕਲਪਨਾ ਦੇ ਹਿਸਾਬ ਨਾਲ ਲਿਖਦਾ ਹੈ ਜਿਸ ਦੀ ਅਤੇ ਕੁਝ ਲੋਕ ਯਥਾਰਥ ਦੇ ਕਲਪਨਾ ਦੇ ਮੇਲ ਨੂੰ ਹੀ ਲਿਖਣ ਦਾ ਵਧੀਆ ਤਰੀਕਾ ਮੰਨਦੇ ਹਨ ਜਿਵੇਂ ਕਿ ਅਸੀਂ ਕਈ ਤਰ੍ਹਾਂ ਨਾਲ ਲਿਖਦੇ ਹਾਂ ਅਸੀਂ ਆਪਣੀ ਲਿਖਤ ਨੂੰ ਪ੍ਰਭਾਵਿਤ ਕਰਨ ਲਈ ਜਿਸ ਤਰ੍ਹਾਂ ਮੇਰਾ ਮੇਨ ਇਹ ਇੱਕ ਲਿਖਣ ਦਾ ਇਹ ਟੋਪਿਕ ਇਹ ਸੀ ਕਿ ਪੂਰਨ ਭਗਤ ਅਤੇ ਦੇ ਕਿੱਸੇ ਦੀ ਰਚਨਾ ਨੂੰ ਕਿਸ ਤਰ੍ਹਾਂ ਬਿਆਨ ਕਰਦਾ ਹੈ ਮੈਂ ਉਸ ਉੱਤੇ ਇੱਕ ਦੋ ਚਾਰ ਪੰਜ ਪੇਜਾਂ ਦਾ ਇੱਕ ਚਿਤਰਨ ਕੀਤਾ ਜੋ ਕਿ ਨਾਰੀ ਸੰਵੇਦਨਾ ਸੀ ਕਿ ਉਹ ਕਿੱਸੇ ਵਿੱਚ ਨਾਰੀ ਲਈ ਕੀ ਕੀ ਯੋਗ ਥਾਂ ਸੀ ਇਸ ਤਰ੍ਹਾਂ ਮੈਂ ਉਸ ਘੜਤ ਨੂੰ ਲਿਖ ਕੇ ਵਧੀਆ ਟੀਚੇ 'ਤੇ ਪਹੁੰਚਾ ਦਿੱਤਾ ਅਤੇ ਮੈਨੂੰ ਇਹ ਪਤਾ ਲੱਗਾ ਕਿ ਉਸ ਸਥਿਤੀ ਵਿੱਚ ਨਾਰੀ ਨੂੰ ਕਿਸ ਕਿਸ ਦਸ਼ਾ ਵਿੱਚੋਂ ਨਿਕਲਣਾ ਪੈਂਦਾ ਹੈ ਅਤੇ ਕਿਸ ਕਿਸ ਥਾਵਾਂ ਵਿੱਚੋਂ ਉਸਨੂੰ ਗੁਜ਼ਰਨਾ ਪੈਂਦਾ ਹੈ ਇਸ ਤਰ੍ਹਾਂ ਹਰ ਇੱਕ ਰਾਈਟਰ ਦਾ ਲੇਖਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਆਪਣੀ ਕਲਮ ਤੋਂ ਲਿਖਣ ਲਈ ਟੀਚਾ ਹਾਸਲ ਕਰੇ ਅਤੇ ਉਸ ਦਾ ਏਮ ਨਿਸ਼ਾਨਾ ਮਿੱਥੇ ਧੰਨਵਾਦ